ਪੰਜਾਬ ਦੀ ਸਾਡੀ ਮੁੱਖ ਭਾਸ਼ਾ ਪੰਜਾਬੀ ਹੈ ਪਰ ਇਸ ਦੇ ਨਾਲ ਨਾਲ ਹੋਰ ਭਾਸ਼ਾਵਾਂ ਵੀ ਇੱਥੇ ਬੋਲੀਆਂ ਜਾਂਦੀਆਂ ਹਨ ਜਿਵੇਂ ਹਿੰਦੀ ਅੰਗਰੇਜ਼ੀ ਇਸ ਤਰ੍ਹਾਂ ਹੀ ਪੰਜਾਬੀ ਦੀਆਂ ਕੁਛ ਕੁ ਉਪਭਾਸ਼ਾਵਾਂ ਹਨ ਜਿਹੜੀਆਂ ਕਿ ਮਾਝੀ ਮਾਲਵੀ ਦੁਆਬੀ ਅਤੇ ਪੁਆਧੀ ਹੈ ਮਾਝੇ ਦਾ ਇਲਾਕਾ ਜੋ ਕਿ ਇੱਧਰ ਅੰਮ੍ਰਿਤਸਰ ਅਤੇ ਗੁਰਦਾਸਪੁਰ ਦਾ ਹੈ ਇਸ ਤਰ੍ਹਾਂ ਹੀ ਮਾਲਵੇ ਦਾ ਇਲਾਕਾ ਲੁਧਿਆਣਾ ਚੰਡੀਗੜ੍ਹ ਦਾ ਕੁਛ ਇਲਾਕਾ ਹੈ ਅਤੇ ਇਸ ਤਰ੍ਹਾਂ ਹੀ ਸਾਡਾ ਜਿਹੜਾ ਪੁਆਧੀ ਦਾ ਇਲਾ ਪੁਆਧ ਹੈ ਉਹ ਹੈ ਇੱਧਰਲੀ ਸਾਈਡ 'ਤੇ ਜਲੰਧਰ ਦੇ ਨਾਲ ਨਵਾਂਸ਼ਹਿਰ ਹੈ ਅਤੇ ਅੰਗਰੇਜ਼ੀ ਸਾਡੀ ਭਾਵੇਂ ਉਪ ਭਾਸ਼ਾ ਦੇ ਵਿੱਚ ਨਹੀਂ ਹੈ ਪਰ ਸਾਡੀ ਕਿਉਂਕਿ ਸਾਡੇ ਇੱਥੇ ਪੜ੍ਹਨ ਦਾ ਇੱਕ ਸਿੱਖਿਆ ਦਾ ਇਹ ਇੱਕ ਮਾਧਿਅਮ ਬਣਿਆ ਹੈ ਅਤੇ ਇਸ ਤਰ੍ਹਾਂ ਹੀ ਪੰਜਾਬੀ ਦੀਆਂ ਹੋਰ ਜਿਹੜੀਆਂ ਸਾਰੀਆਂ ਮੁੱਖ ਭਾਸ਼ਾਵਾਂ ਜਾਂ ਉਪ ਭਾਸ਼ਾਵਾਂ ਹਨ ਅਤੇ ਇਹ ਸਾਡੇ ਆਪਸ ਦੇ ਵਿੱਚ ਲੋਕਾਂ ਦੇ ਬੋਲਚਾਲ ਦੇ ਵਿੱਚ ਉਹਨਾਂ ਦੀ ਆਪਸੀ ਸਾਂਝ ਬਣਾਈ ਰੱਖਦੀਆਂ ਹਨ